ਹੈਲੋ ਠੀਕ ਨੇ ਤੁਸੀਂ ਸੁਣਾਓ ਮੇਰੇ ਤਾਂ ਬਹੁਤ ਵਧੀਆ ਗਏ ਤੁਹਾਡੇ ਕਿਵੇਂ ਦੇ ਗਏ ਹਾਂਜੀ ਹੋਰ ਅੱਗੇ ਬਾਰੇ ਕੀ ਸੋਚਿਆ ਹਾਂ ਹਾਂ ਸਾਈ ਕਾਲਜ ਸਭ ਤੋਂ ਬੈਟਰ ਆ ਹਾਂ ਹਾਂ ਇਹ ਵੀ ਬੈਟਰ ਹੈ ਨਾਲ ਬਹੁਤ ਜ਼ਿਆਦਾ ਸੁਣਿਆ ਸੀ ਸਾਈ ਕਾਲਜ ਸਭ ਤੋਂ ਬੈਟਰ ਆ ਹਾਂ ਫਿਰ ਇਸ ਬਾਰੇ ਘਰਦਿਆਂ ਨਾਲ ਗੱਲ ਕਰਕੇ ਦੇਖ ਲਵਾਂਗੇ ਜੇ ਉਹ ਮੰਨਣਗੇ ਤਾਂ ਫਿਰ ਹਾਂ ਹਾਂ ਹਾਂਜੀ ਠੀਕ ਹੈ